ਸਾਡੇ ਸੱਭਿਆਚਾਰ ਵਿੱਚ ਔਰਤਾਂ ਦੀ ਮਾਹਵਾਰੀ ਦੀ ਗੱਲ ਕਰੀਏ ਪੁਰਾਣੇ ਸਮੇਂ ਵਿੱਚ ਔਰਤਾਂ ਨੂੰ ਜਿਹੜੀ ਮਾਹਵਾਰੀ ਆ ਸੋਲ੍ਹਾਂ ਸਤਾਰਾਂ ਸਾਲ ਦੀ ਉਮਰ ਵਿੱਚ ਆਉਂਦੀ ਸੀਗੀ ਵੀ ਸਮਝਦਾਰ ਹੋ ਜਾਂਦੀ ਸੀ ਔਰਤ ਜਦੋਂ ਉਹਨਾਂ ਨੂੰ ਮਾਹਵਾਰੀ ਦੀ ਪ੍ਰੋਬਲਮ ਹੁੰਦੀ ਸੀ ਪਰ ਅੱਜ ਦੇ ਯੁੱਗ ਵਿੱਚ ਇਹ ਪ੍ਰੋਬਲਮ ਬਾਰਾਂ ਤੇਰ੍ਹਾਂ ਸਾਲ ਦੀਆਂ ਕੁੜੀਆਂ ਨੂੰ ਹੋ ਜਾਂਦੀ ਹੈ ਇਸ ਵਿੱਚ ਸਰਕਾਰ ਨੇ ਗੌ ਕੁੜੀਆਂ ਨੂੰ ਫਰੀ ਪੈਡਸ ਇਸ਼ੂ ਕੀਤੇ ਹੈ ਤਾਂ ਜੋ ਕਿ ਇਹ ਜ਼ਿਆਦਾ ਇਨਫੈਕਸ਼ਨ ਨਾ ਵੱਧ ਸਕੇ ਸਰਕਾਰ ਇਹ ਪੈਡਸ ਬਿਲਕੁਲ ਫਰੀ ਇਹ ਕੈਂਪਾਂ ਵਿੱਚ ਵੀ ਸਾਨੂੰ ਦਿੱਤੇ ਜਾਂਦੇ ਹੈਗੇ ਆ ਪੁਰਾਣੇ ਸਮੇਂ ਵਿੱਚ ਔਰਤਾਂ ਜਿਹੜੀਆਂ ਸੀਗੀਆਂ ਉਹ ਕੱਪੜਾ ਯੂਸ ਕਰਦੀਆਂ ਸੀਗੀਆਂ ਜਿਸ ਨਾਲ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਸੀ ਬੱਚੇਦਾਨੀ ਦਾ ਵੀ ਕੈਂਸਰ ਬਣ ਜਾਂਦਾ ਸੀਗਾ ਕਿਉਂਕਿ ਉਹ ਬਾਰ ਬਾਰ ਉਹੀ ਕੱਪੜਾ ਧੋ ਕੇ ਯੂਸ ਕਰ ਲੈਂਦੀਆਂ ਸੀ ਜਿਸ ਕਾਰਨ ਤਰ੍ਹਾਂ ਤਰ੍ਹਾਂ ਦੇ ਰੋਗ ਲੱਗ ਜਾਂਦੇ ਸੀਗੇ ਇਸ ਅੰਦਰ ਆਉਣ ਜੇ ਹੁਣ ਸਰਕਾਰ ਨੇ ਜਿਹੜੇ ਪੈਡਸ ਇਸ਼ੂ ਕੀਤੇ ਹੈਗੇ ਉਹਨਾਂ ਨੂੰ ਟਰੈਸ਼ ਕਰਨ ਵਾਲੀ ਮਸ਼ੀਨ ਵੀ ਇਸ਼ੂ ਕੀਤੀ ਹੋਈ ਹੈ ਜਿਸ ਕਾਰਨ ਅਸੀਂ ਉਸਨੂੰ ਟਰੈਸ਼ ਵੀ ਕਰ ਸਕਦੇ ਹੈਗੇ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਪਰਾ ਪਹਿਲਾਂ ਔਰਤਾਂ ਨੂੰ ਜੇ ਇਸ ਦੇ ਇਲਾਜ ਦੀ ਗੱਲ ਕਰੀਏ ਜਿਵੇਂ ਪੇਟ ਦਰਦ ਹੋ ਰਿਹਾ ਅਸੀਂ ਉਸਦੇ ਦੌਰਾਨ ਅਸੀਂ ਜੋਮੈਨ ਪੀ ਸਕਦੇ ਹਾਂ ਉਬਾਲ ਕੇ ਇਸ ਕੁਛ ਬੈਕ ਪੇਨ ਹੋ ਰਹੀ ਹੈ ਕੁਛ ਓਦਾਂ ਦਾ ਅਸੀਂ ਜ਼ਿਆਦਾ ਰੈਸਟ ਕਰ ਸਕਦੇ ਹੈਗੇ ਮਤਲਬ ਕਿ ਇਹ ਜਿਹੜੀ ਮਾਹਵਾਰੀ ਹੈ ਇਸ ਵਿੱਚ ਔਰਤਾਂ ਨੂੰ ਰੈਸਟ ਬਹੁਤ ਜ਼ਰੂਰੀ ਹੈ ਇਸ ਨਾਲ ਕਿਸੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਬਹੁਤ ਸਾਰੀਆਂ ਔਰਤਾਂ ਦਾ ਪੇਟ ਦਰਦ ਵੀ ਹੁੰਦਾ ਅਤੇ ਬੁੱਲ ਸੁੱਕ ਜਾਂਦੇ ਹੈ ਅਤੇ ਬੈਕ ਪੇਨ ਬਹੁਤ ਹੁੰਦਾ ਹੈਗਾ ਲ ਲੱਤਾਂ ਦਾ ਬਹੁਤ ਜ਼ਿਆਦਾ ਦਰਦ ਜਿਸ ਕਰਨ ਉਹਨਾਂ ਨੂੰ ਰੈਸਟ ਦੀ ਬਹੁਤ ਲੋੜ ਹੁੰਦੀ ਹੈ ਇਸ ਲਈ ਉਹਨਾਂ ਨੂੰ ਵੱਧ ਤੋਂ ਵੱਧ ਰੈਸਟ ਦਿੱਤੀ ਜਾਂਦੀ ਹੈਗੀ ਅਗਰ ਉਹਨਾਂ ਦੇ ਪੇਟ ਦਰਦ ਦੀ ਜ਼ਿਆਦਾ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਪਾਣੀ ਉਬਾਲ ਕੇ ਆਪਣੇ ਪੇਟ 'ਤੇ ਸੇਕ ਕਰਨਾ ਚਾਹੀਦਾ ਹੈਗਾ ਅਤੇ ਉਹਨਾਂ ਨੂੰ ਕੁਛ ਨਾ ਉਹ ਉਹ ਮਤਲਬ ਠੰਢੀ ਚੀਜ਼ ਨਹੀਂ ਖਾਣੀ ਗਰਮ ਤੋਂ ਗਰਮ ਚੀਜ਼ ਖਾਣੀ ਚਾਹੀਦੀ ਹੈ ਮੇਰਾ ਇਹੀ ਸੁਝਾਅ ਹੈਗਾ ਵੀ ਔਰਤਾਂ ਨੂੰ ਆਪਣੀ ਸ ਮਾਹਵਾਰੀ ਦੌਰਾਨ ਵੱਧ ਤੋਂ ਵੱਧ ਧਿਆਨ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇੱਕ ਸਵੱਛ ਸਿਹਤ ਬਣਾਏ ਇਸ ਲਈ ਸਰਕਾਰ ਨੇ ਵੀ ਸਾਨੂੰ ਜਿਹੜੇ ਫਰੀ ਕੈਂਪਾਂ ਦੇ ਵਿੱਚ ਪੈਡਸ ਇਸ਼ੂ ਕਰਵਾਏ ਸਾਨੂੰ ਉਹ ਹੀ ਯੂਸ ਕਰਨੇ ਚਾਹੀਦੇ ਹੈ ਕੱਪੜਾ ਨਹੀਂ ਯੂਸ ਕਰਨਾ ਤਾਂ ਕਿ ਅਸੀਂ ਬਿਮਾਰੀਆਂ ਤੋਂ ਬਚ ਸਕੀਏ ਧੰਨਵਾਦ